ਹਾਂਜੀ ਬ੍ਰਦਰਜ਼ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਮੈਂ ਔਡਰ ਕੀਤਾ ਸੀ ਹੁਣੇ ਇੱਕ ਸ਼ਾਹੀ ਪਨੀਰ ਦੋ ਪਲੇਟ ਅਤੇ ਤਿੰਨ ਬਟਰ ਨਾਨ ਨਾਲ ਪੰਜ ਸਪਲੇਨ ਚਪਾਤੀ ਅਤੇ ਕਿੰਨੀ ਦੇਰ ਤੱਕ ਆ ਜਾਉਂਗੇ ਅੱਛਾ ਅਤੇ ਅੱਜ ਕੱਲ੍ਹ ਠੰਡ ਬੜੀ ਹੈ ਅਤੇ ਮੈਂ ਕਹਿ ਰਿਹਾ ਸੀ ਤੁਸੀਂ ਜੇ ਤੁਸੀਂ ਆਪਣੇ ਉਹ ਕੰਟੇਨਰ ਸਹੀ ਯੂਜ ਕਰੋਂਗੇ ਜਿਹਦੇ ਨਾਲ ਗਰਮ ਰਹੇ ਰੋਟੀ ਵਗੈਰਾ ਕਿਉਂਕਿ ਉਹ ਬਟਰ ਨਾਨ ਜਿਹੜੇ ਹੈ ਉਹ ਠੰਡੇ ਹੋ ਕੇ ਬੜੇ ਬੇਕਾਰ ਜਿਹੇ ਹੋ ਜਾਂਦੇ ਹਾਡ ਜਿਹੇ ਹੋ ਜਾਂਦੇ ਤੁਸੀਂ ਇੱਦਾਂ ਕਰੋ ਜੇ ਤੁਹਾਡੇ ਕੋਲ ਇੰਸੂਲੇਟਡ ਬੈਗ ਹੈਗੇ ਜੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤਾਂ ਬਹੁਤ ਵਧੀਆ ਰਹੇਗਾ ਅ ਹਾਂਜੀ ਹਾਂਜੀ ਮੈਂ ਦਸ਼ਮੇਸ਼ ਐਵੇਨਿਊ ਰਹਿੰਦਾ ਕਾਫੀ ਕਿੰਨਾ ਟਾਈਮ ਲੱਗ ਜੇਗਾ ਤੁਹਾਨੂੰ ਅੱਛਾ ਚਾਲੀ ਮਿੰਟ ਲੱਗੂਗੇ ਭਾਅ ਜੀ ਠੰਡ ਬਹੁਤ ਆ ਦੇਖ ਲਿਓ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਅਤੇ ਸਵੇਰ ਦਾ ਮੈਂ ਕੁਝ ਨਹੀਂ ਖਾਇਆ ਅਤੇ ਠੰਡ ਬੜੀ ਹੈ ਨਾਲੇ ਰੋਟੀ ਗਰਮ ਗਰਮ ਨਾ ਹੋਵੇ ਤਾਂ ਮਜ਼ਾ ਨਹੀਂ ਆਉਂਦਾ ਦੇਖ ਲਿਓ ਜੇ ਤੁਸੀਂ ਕਰ ਸਕਦੇ ਹੋ ਮੈਂ ਜੇ ਤੁਸੀਂ ਕਰੋਂਗੇ ਸਹੀ ਤਾਂ ਅਰਾਮ ਨਾਲ ਤੁਹਾਡੀ ਰੇਟਿੰਗ ਸਹੀ ਵਧੀਆ ਦਊਂਗਾ ਅਤੇ ਡਿਲੀਵਰੀ ਬੋਆਏ ਨੂੰ ਤੁਸੀਂ ਪੂਰੇ ਇੰਸਟਰਕਸ਼ਨ ਦੇ ਕੇ ਭੇਜਿਓ ਕਿ ਫੋਈਲ ਪੇਪਰ ਜ਼ਿਆਦਾ ਯੂਜ ਕਰ ਲਵੇ ਜਾਂ ਫਿਰ ਕੰਟੇਨਰ ਇੱਦਾਂ ਦਾ ਯੂਜ਼ ਕਰੇ ਜਿਹਦੇ ਨਾਲ ਗਰਮ ਜ਼ਿਆਦਾ ਰਵੇ ਰੋਟੀ ਹਾਂਜੀ ਹਾਂਜੀ ਅਤੇ ਮੈਂ ਕਹਿ ਰਿਹਾ ਸੀ ਕਿ ਤੁਸੀਂ ਨਾਲ ਜੇ ਆਪਣਾ ਕਟਲਰੀ ਜੇ ਭੇਜ ਦਉਂਗੇ ਸਹੀ ਤਰ੍ਹਾਂ ਉਹ ਵੀ ਵਧੀਆ ਰਹੇਗਾ ਹਾਂਜੀ ਜਿਵੇਂ ਉਹ ਫੋਕ ਵਗੈਰਾ ਅਤੇ ਸਪੂਨਸ ਵਗੈਰਾ ਹਾਂਜੀ ਨਾਲ ਪਲਾਸਟਿਕ ਦੀ ਇੱਕ ਪਲੇਟ ਜੀ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਟਰਾਈ ਕਰਿਓ ਜੀ ਗਰਮ ਰਹੇ ਬਾਕੀ ਮੈਂ ਤੁਹਾਡੀ ਰੇਟਿੰਗ ਵਧੀਆ ਦੇ ਦਾਂਗਾ ਹਾਂਜੀ